ਹੈਲੋ ਹਾਂਜੀ ਬੋਲੋ ਹਾਂ ਸੁਬਹਾ ਦਾ ਮਹੂਰਤ ਹੈਗਾ ਇੱਕ ਅਲਸੀ ਦਾ ਉਹ ਜਿਹੜਾ ਖਾਣਾ ਹੁੰਦਾ ਉਹ ਬਣਾ ਲਾਂਗੇ ਸ਼ਿਵਰਾਤਰੀ ਦੀ ਜਦੋਂ ਇੱਧਰ ਕੀਤਾ ਸੀ ਉਦੋਂ ਵੀ ਤਾਂ ਐਵੇਂ ਹੀ ਕੀਤਾ ਸੀ ਸ਼ਿਵਰਾਤਰੀ 'ਤੇ ਵੀ ਐਵੇਂ ਹੀ ਵਰਤ ਵਾਲਾ ਹੀ ਕੰਮ ਸੀ ਪੰਜ ਬੜੇ ਹੋਣਗੇ ਪੰਜਾਂ ਤੇ ਜਾ ਉਹ ਸ਼ਾਸ਼ਤਰੀ ਬੁਲਾਉਣੇ ਆ ਨਾ ਬ੍ਰਹਮ ਵਾਲੇ ਹਾਂ ਹਾਂ ਹਾਂ ਹਾਂ ਬਸ ਕੱਲ੍ਹ ਨੂੰ ਪਨੀਰ ਦੀ ਸਬਜ਼ੀ ਹੋਵੇਗੀ ਅਤੇ ਨਹੀਂ ਉਹ ਅੱਗੇ ਉਹ ਮੂਰਤੀ ਲਗਾਈ ਸੀ ਨਾ ਉਹ ਹੀ ਇਹ ਠੀਕ ਆ ਮੂਰ ਮੂਰਤੀ ਅੱਗੇ ਕਰ ਗਈ ਸੀ ਉਹ ਪੁੱਛਾਂ ਪੁੱਛ ਲਾਂਗੇ ਫੋਨ ਹੈਗਾ ਮੇਰੇ ਕੋਲ ਉਹਦਾ ਨੰਬਰ ਹੁੰ ਠੀਕ ਹੈ ਅ ਸਮਾਨ ਨਹੀਂ ਇੱਕ ਵਾਰ ਲਿਜਾਣਾ ਗਾ ਪਹਿਲਾਂ ਸਮਾਨ ਬਾਅਦ 'ਚ ਹਾਂ ਪਹਿਲਾਂ ਕਲਸ਼ ਭਰ ਕੇ ਰੱਖੀਦਾ ਸਮਾਨ ਅਗਲੇ ਦਿਨ ਗੈਸ ਇਕੱਲੀ ਲਿਜਾ ਸਕਦੇ ਚੁੱਲ੍ਹਾ ਕਿਹਨੂੰ ਹਾਂ ਤੇ ਲੋਕ ਨਹੀਂ ਲੋਕ ਨਹੀਂ ਕਰਾਂਗੇ ਲੋਕ ਉੱਥੇ ਹੀ ਸੋਵਾਂਗੇ ਸੋਣ ਦਾ ਤਾਂ ਉੱਥੇ ਹੀ ਰੱਖਾਂਗੇ ਸਮਾਨ ਵੀ ਅਸੀਂ ਉੱਪਰ ਹੌਲੀ ਹੌਲੀ ਜਾਵੇਗਾ ਨਾ ਪਹਿਲਾਂ ਨਹੀਂ ਲੈ ਕੇ ਜਾਈ ਦਾ ਪੂਜਾ ਤੋਂ ਹਵਨ ਤੋਂ ਪਹਿਲਾਂ ਠੀਕ ਹੈ ਓਕੇ